ਸਤਿ ਸ਼੍ਰੀ ਅਕਾਲ ਜੀ ਹਾਂਜੀ ਜੀ

ਹਾਂਜੀ ਹਾਂਜੀ

ਹਾਂਜੀ ਹਾਂ ਤੁਸੀਂ ਆ ਜਿਓ ਫਤਿਹਗੜ੍ਹ ਸਾਹਿਬ ਮੈਂ ਉਰੇ ਗੁਰੂ ਘਰ 'ਚੋਂ ਹੀ ਬੋਲ ਰਿਹਾਂ ਫਤਿਹਗੜ੍ਹ ਸਾਹਿਬ ਗੁਰਦੁਆਰੇ ਤੋਂ ਵੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਸਥਾਨ ਹਨ ਹਾਂਜੀ ਹਾਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਇੱਥੇ ਕੰਧ ਵਿੱਚ ਸ਼ਹੀਦ ਕੀਤਾ ਸੀ ਹਾਂਜੀ ਉੱਥੇ ਠੰਡੇ ਬੁਰਜ 'ਚ ਜਿੱਥੇ ਮਾਤਾ ਗੁਜਰੀ ਜੀ ਨਾਲ ਛੋਟੇ ਸਾਹਿਬਜ਼ਾਦਿਆਂ ਨੂੰ ਰੱਖਿਆ ਸੀ ਅਤੇ ਨੇੜੇ ਹੀ ਗੁਰਦੁਆਰਾ ਜੋਤੀ ਸਰੂਪ ਹੈ ਜਿੱਥੇ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰਕੇ ਸਸਕਾਰ ਵਾਸਤੇ ਜਿਹੜੀ ਜ਼ਮੀਨ ਖਰੀਦੀ ਸੀ ਜੋ ਕਿ ਵਿਸ਼ਵ 'ਚ ਸਭ ਤੋਂ ਮਹਿੰਗੀ ਜ਼ਮੀਨ ਕਹੀ ਜਾਂਦੀ ਹੈ ਹਾਂਜੀ ਬਾਕੀ ਇੱਧਰ ਹੁਣ ਸ਼ਹੀਦੀ ਜੋੜ ਮੇਲ ਦੀ ਡੇਟ ਹੈਗੀ ਹੈ ਛੱਬੀ ਸਤਾਈ ਅਠਾਈ ਦਸੰਬਰ ਉਹ ਦਿਨਾਂ 'ਚ ਤੁਸੀਂ ਉਰੇ ਪਹੁੰਚੋ ਹਾਂਜੀ ਉਸ ਦਿਨ ਹਾਂ ਹਾਂਜੀ ਹਾਂ ਤੁਸੀਂ ਉਸ ਦਿਨ ਜ਼ਰੂਰ ਪਹੁੰਚੋ ਆਲੇ ਦੁਆਲੇ ਸਾਰੇ ਪਾਸੇ ਪਿੰਡਾਂ ਵੱਲੋਂ ਲੰਗਰ ਲਾਏ ਲੰਗਰ ਲਾਏ ਹੁੰਦੇ ਐਂ ਪੱਗਾਂ ਵਾਲੇ ਮੁਕਾਬਲੇ ਕਰਵਾਏ ਜਾਂਦੇ ਹਨ ਨਗਰ ਕੀਰਤਨ ਹੁੰਦਾ ਗੱਤਕੇ ਦੇ ਮੁਕਾਬਲੇ ਹੁੰਦੇ ਹਨ ਤੁਸੀਂ ਉਰੇ ਪਹੁੰਚੋ ਇਹ ਬਹੁਤ ਹੀ ਦੇਖਣਯੋਗ ਦ੍ਰਿਸ਼ ਹੈ ਹਾਂਜੀ ਹਾਂ ਤੁਸੀਂ ਉਰੇ ਉਸ ਦਿਨਾਂ 'ਚ ਆ ਕੇ ਠੀਕ ਹੈ ਜੀ